ਸਾਡੇ ਖੇਤਰ ਵਿੱਚ ਕੁਦਰਤੀ ਸ੍ਰੋਤ ਜਿਵੇਂ ਕਿ ਨਹਿਰਾਂ ਦਾ ਪਾਣੀ ਅਤੇ ਖੱਡਾਂ ਤੋਂ ਰੇਤਾ ਬਜਰੀ ਆਦਿ ਕ ਜੋ ਵੀ ਕੁਦਰਤੀ ਸ੍ਰੋਤ ਹਨ ਉਹਨਾਂ ਤੋਂ ਸਾਨੂੰ ਨਹਿਰਾਂ ਤੋਂ ਜਿਸ ਤਰ੍ਹਾਂ ਪਾਣੀ ਖੇਤੀ ਵਾਸਤੇ ਮਿਲਦਾ ਹੈ ਉਪਜਾਊ ਖੇਤੀ ਵਧੀਆ ਵੱਧਦੀ ਹੈ ਉਹਦੇ ਨਾਲ਼ ਅਤੇ ਖੱਡਾਂ ਵਿੱਚੋਂ ਰੇਤਾਂ ਲੈ ਕੇ ਬਿਲਡਿੰਗ ਕੰਨਸਟ੍ਰੱਕਸ਼ਨ ਦੇ ਵਿੱਚ ਬੜੀ ਵਰਤੋਂ ਹੋ ਰਹੀ ਆ ਜਿਸ ਨਾਲ਼ ਜਨ ਜੀਵਨ ਸਾਡਾ ਤਰੱਕੀ ਵੱਧ ਸਕੇ